ਮੇਰਾ ਨਾਮ ਰਾਕੇਸ਼ ਹੈ ਮੈਂ ਸੁਜਾਨਪੁਰ ਦੀ ਵਾਸੀ ਹਾਂ ਜ਼ਿਲ੍ਹਾ ਪਠਾਨਕੋਟ ਮੇਰੇ ਦੁਆਰਾ ਪੜ੍ਹੀ ਗਈ ਆਖਰੀ ਕਿਤਾਬ ਸੀ ਜੋ ਕਿ ਹਲੇ ਥੋੜ੍ਹੇ ਦਿਨ ਪਹਿਲਾਂ ਹੀ ਮੈਂ ਖਤਮ ਕੀਤੀ ਇੱਕ ਹੋਰ ਨਵਾਂ ਸਾਲ ਜੋ ਕਿ ਨਿਰੰਜਨ ਤਸਨੀਮ ਦੀ ਲਿਖੀ ਹੋਈ ਨਾਵਲ ਹੈ ਜਿਸ ਵਿੱਚ ਮੈਂ ਬਹੁਤ ਪ੍ਰਭਾਵਿਤ ਹੋਈ ਕਿ ਇੱਕ ਬਹੁਤ ਹੀ ਗਰੀਬ ਫੈਮਿਲੀ ਦਾ ਹੋਕੇ ਉਸ ਦੇ ਸਪਨੇ ਜਿਹੜੇ ਨੇ ਬਹੁਤ ਹੀ ਉੱਚੇ ਹਨ ਜਿਸਦੇ ਵਿੱਚ ਉਹ ਸਵੇਰੇ ਸਵੇਰੇ ਉੱਠ ਕੇ ਆਪਣੀ ਪਤਨੀ ਦੇ ਕੋਲੋਂ ਬੈੱਡ ਟੀ ਮੰਗਦਾ ਹੈ ਤਾਂ ਉਹ ਕਹਿੰਦੀ ਹੈ ਇਹ ਬੈੱਡ ਟੀ ਕੀ ਹੁੰਦੀ ਹੈ ਤਾਂ ਉਹ ਕਹਿੰਦਾ ਹੈ ਭੋਲੀਏ ਬੈੱਡ ਟੀ ਉਹ ਹੁੰਦੀ ਹੈ ਜੋ ਸਵੇਰੇ ਸਵੇਰੇ ਅਮੀਰ ਲੋਕ ਇੱਕ ਚਾਹ ਦਾ ਕੱਪ ਪੀਂਦੇ ਹਨ ਇਸੇ ਹੀ ਤਰ੍ਹਾਂ ਉਹ ਸਵੇਰ ਨੂੰ ਜਦੋਂ ਸਵੇਰੇ ਪੰਜ ਵਜੇ ਕਾਲਕਾ ਟਰੇਨ ਦੀ ਵੇਟ ਵਾਸਤੇ ਚਲਾ ਜਾਂਦਾ ਹੈ ਕਿ ਸਵਾਰੀਆਂ ਉਸ ਨੇ ਅੰਮ੍ਰਿਤਸਰ ਤੋਂ ਚੁੱਕਣੀਆਂ ਹਨ ਅਤੇ ਜਗ੍ਹਾ ਜਗ੍ਹਾ ਪਹੁੰਚਾਉਣੀਆਂ ਹਨ ਉਹ ਆਪਣੇ ਕੰਮ ਦੇ ਵਿੱਚ ਬਹੁਤ ਹੀ ਮਨ ਲਾ ਕੇ ਕੰਮ ਕਰਦਾ ਹੈ ਛੋਟੇ ਹੁੰਦਿਆਂ ਹੀ ਉਸ ਦੇ ਪਿਤਾ ਦੀ ਮ੍ਰਿਤਿਊ ਹੋ ਜਾਂਦੀ ਹੈ ਅਤੇ ਸਾਰੇ ਘਰ ਦਾ ਬੋਝ ਉਸ ਦੇ ਸਿਰ ਪੈ ਜਾਂਦਾ ਹੈ ਜਿਸ ਦੇ ਕਾਰਨ ਉਹ ਆਪਣੇ ਪਿੰਡ ਦੀ ਪਿੰਡ ਨੂੰ ਛੱਡ ਕੇ ਆਉਂਦਾ ਹੈ ਆਉਣਾ ਪੈਂਦਾ ਹੈ ਅਤੇ ਨਾਲੇ ਉਸ ਨੂੰ ਆਪਣੀ ਪੜ੍ਹਾਈ ਵੀ ਵਿੱਚੇ ਹੀ ਛੱਡਣੀ ਪੈਂਦੀ ਹੈ ਉਹ ਚੌਥੀ ਪਾਸ ਹੈ ਅਤੇ ਪੰਜਵੀਂ ਫੇਲ ਹੈ ਪਰ ਫੇਰ ਵੀ ਜੀਵਨ ਦੇ ਹਰ ਰੰਗ ਨੂੰ ਉਹ ਚੰਗੀ ਤਰ੍ਹਾਂ ਮਾਣਦਾ ਹੈ ਜਿਵੇਂ ਕਿ ਉਸ ਦੇ ਨਾਲ ਇੱਕ ਉਸਦਾ ਸ ਜੋ ਚਲੋ ਰਿਕਸ਼ਾ ਚਾਲਕ ਹੈ ਜਦੋਂ ਉਹਦੇ ਨਾਲ ਗੱਲ ਬਾਤ ਕਰਦਾ ਹੈ ਤਾਂ ਬੜੀ ਖੁਸ਼ਨੁਮਾ ਢੰਗ ਨਾਲ ਉਸਨੂੰ ਜਵਾਬ ਦਿੰਦਾ ਹੈ ਗਾਣੇ ਗਾਉਂਦਾ ਹੈ ਅਤੇ ਜ਼ਿੰਦਗੀ ਦੇ ਰੰਗ ਨੂੰ ਮਾਣਦਾ ਹੈ ਇੱਕ ਗਰੀਬ ਫੈਮਿਲੀ ਹੋਣ ਦੇ ਕਾਰਨ ਵੀ ਉਹ ਆਪਣੇ ਪਰਿਵਾਰ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕਰਦਾ ਹੈ ਆਪਣੀ ਪਤਨੀ ਨੂੰ ਖੁਸ਼ ਰੱਖਦਾ ਹੈ ਆਪਣੀ ਮਾਂ ਨੂੰ ਖੁਸ਼ ਰੱਖਦਾ ਹੈ ਅਤੇ ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਵੀ ਪੂਰੀ ਤਰ੍ਹਾਂ ਸ਼ਾਮਲ ਹੁੰਦਾ ਹੈ ਅਤੇ ਉਨ੍ਹਾਂ ਨੂੰ ਵੱਧਦੇ ਫੁੱਲਦੇ ਦੇਖਣਾ ਚਾਹੁੰਦਾ ਹੈ ਜਿਸ ਨਾਲ ਉਹ ਆਪਣੀ ਬੇਟੀ ਨੂੰ ਆਪਣੇ ਬੇਟੇ ਨੂੰ ਪੜ੍ਹਾਉਣਾ ਚਾਹੁੰਦਾ ਹੈ ਇਹੀ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਇਸ ਨਾਵਲ ਦੀ ਪ੍ਰਭਾਵਿਤ ਕੀਤਾ ਗਰੀਬ ਹੋਣ ਦੇ ਬਾਵਜੂਦ ਵੀ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹੈ ਧੰਨਵਾਦ